ਸਪੀਕ ਆਊਟ ਦਾ ਫਲੋਇੰਗ ਨੇਮਸ ਆਫ ਵਾਈਕਲ ਹਿੰਟ ਡੀ ਆਰ ਐਫ ਥਰਟੀ ਫਾਈਵ ਟੋਇਟਾ ਜੈਰਿਸ ਹੈਚਬੈਕ ਵੀ ਯੂ ਐਚ ਐਲ ਜੀਰੋ ਫਾਈਵ